ਪੁਲਿਸ ਸਾਡੇ ਖੇਤਰ ਵਿੱਚ ਜਿਹੜੀਆਂ ਦੁਰਘਟਨਾਵਾਂ ਅਤੇ ਅਪਰਾਧ ਨੂੰ ਰੋਕਣ ਲਈ ਬਹੁਤ ਹੀ ਚੰਗੀ ਤਰ੍ਹਾਂ ਕੰਟਰੋਲ ਕਰ ਰਹੀ ਆ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਮਸਲਾ ਚੋਰੀਆਂ ਵੱਧ ਰਹੀਆਂ ਇਸ ਦੇ ਨਾਲ ਥਾਂ ਥਾਂ 'ਤੇ ਨਾਕੇ ਲੱਗ ਰਹੇ ਆ ਜਿਸ ਦੇ ਨਾਲ ਜਿਹੜੇ ਆ ਚੋਰੀਆਂ ਉਹ ਘੱਟ ਹੋਣ ਦੀ ਸਮੱਸਿਆ ਹਾਂਜੀ ਜਿਹੜੀ ਹੱਲ ਕੀਤੀ ਜਾ ਸਕਦੀ ਆ ਅਤੇ ਫਿਰ ਜਿਸ ਤਰ੍ਹਾਂ ਜਿਹੜੇ ਕਿ ਨਸ਼ੇ ਵਗੈਰਾ ਵਾ ਉਹਨਾਂ ਨੂੰ ਵੀ ਰੋਕਣ ਲਈ ਜਿਹੜੀ ਪੁਲਿਸ ਆ ਉਹ ਬੜੀਆਂ ਬੜੀ ਚੰਗੀ ਤਰੀਕੇ ਨਾਲ ਕੰਮ ਕਰ ਰਹੀ ਆ ਜਿਸ ਨਾਲ ਡਰ ਬਣਿਆ ਰਹਿੰਦਾ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਅਤੇ ਕਿਉਂਕਿ ਖੁੱਲ੍ਹ ਜੇਕਰ ਉਹਨਾਂ ਨੂੰ ਖੁੱਲ੍ਹ ਮਿਲਦੀ ਹੈ ਤਾਂ ਉਹ ਤਾਂ ਸ਼ਰੇਆਮ ਇਹਨਾਂ ਚੋਰੀਆਂ ਨਸ਼ੇ ਆਦਿ ਵੇਚਣ ਨਾ ਪਰ ਪੁਲਸ ਜਿਹੜੀ ਕਿ ਉਹ ਹਰੇਕ ਖੇਤਰ ਵਿੱਚ ਡਿਊਟੀਆਂ ਲੱਗੀਆਂ ਹਰੇਕ ਪਿੰਡਾਂ ਜ਼ਿਲ੍ਹਿਆਂ 'ਚ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਜਿਸ ਨਾਲ ਜਿਸ ਨਾਲ ਜਿਹੜੀ ਨਾਗਰਿਕਾਂ ਨੂੰ ਅ ਜਿਹੜੀ ਅ ਸੁਰੱਖਿਆ ਵਾ ਉਹ ਮਿਲਦੀ ਐਨ ਜਿਹੜੇ ਕਈ ਜਿਹੜੇ ਪਛੜੇ ਇਲਾਕੇ ਜਿਸ ਤਰ੍ਹਾਂ ਅ ਆਵਾਜਾਈ ਘੱਟ ਆ ਉੱਥੇ ਚੋਰੀ ਦੀ ਸਮੱਸਿਆ ਜ਼ਿਆਦਾ ਹੁੰਦੀ ਆ ਉਹਨਾਂ ਨੂੰ ਰੋਕਣ ਲਈ ਵੀ ਉੱਥੇ ਕਈ ਜਗ੍ਹਾ 'ਤੇ ਅ ਪੁਲਿਸ ਨਾਕੇ ਲਗਾ ਕੇ ਰੱਖਦੀ ਹੈ ਜਿਸ ਨਾਲ ਜਿਹੜੀ ਕਿ ਆਉਣ ਜਾਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਅਤੇ ਸੁਧਾਰ ਅਜੇ ਹੋਰ ਵੀ ਸੁਧਾਰ ਕਰਨ ਦੀ ਲੋੜ ਆ ਇਹ ਕਿਉਂਕਿ ਨਸ਼ੇ ਵਗੈਰਾ ਜਿਹੜੇ ਵੱਧ ਚੁੱਕੇ ਆ ਇਸ ਲਈ ਸ ਹੋਰ ਵੀ ਸਖ਼ਤ ਹੋ ਕੇ ਕੰਮ ਕਰਨ ਦੀ ਲੋੜ ਆ